ਮੈਂ ਯੋਗਾ ਖੁੱਲੇ ਪਾਰਕ ਵਿੱਚ ਹਰਿਆਲੀ ਵਿੱਚ ਕਰਦੇ ਹਾਂ ਤੇ ਉਥੇ ਆਕਸੀਜਨ ਬਹੁਤ ਜਿਆਦਾ ਵਧੀਆ ਮਿਲਦੀ ਹੈ ਤੇ ਯੋਗਾ ਵੀ ਵਧੀਆ ਹੁੰਦੀ ਹੈ